ਹੈਲੋ ਹਾਂਜੀ ਡਰਾਈਵਰ ਸਾਬ੍ਹ ਤੁਸੀਂ ਪਹੁੰਚੇ ਨਹੀਂ ਅਜੇ ਤੱਕ ਅਸੀਂ ਗੱਡੀ ਬੁੱਕ ਕਰਵਾਈ ਸੀ ਤੁਹਾਡੇ ਕੋਲ ਅਸੀਂ ਇੱਥੇ ਸਬਜ਼ੀ ਮੰਡੀ ਸਟੇਸ਼ਨ ਬਾਹਰ ਖੜ੍ਹੇ ਹਾਂ ਹਾਂਜੀ ਨਹੀਂ ਤੁਹਾਨੂੰ ਇਹੀ ਟਾਈਮ ਦਿੱਤਾ ਸੀ ਪੰਜ ਵਜੇ ਦਾ ਹੁਣ ਤਾਂ ਦੇਖੋ ਪੰਜ ਵੀਹ ਹੋਣ 'ਤੇ ਆਏ ਹੈ ਅਸੀਂ ਕਦੋਂ ਦੀ ਤੁਹਾਡੀ ਵੇਟ ਕਰ ਰਹੇ ਹਾਂ ਸਾਡੀ ਅਗਲੀ ਟਰੇਨ ਨਈਂ ਦਿੱਲੀ ਸਟੇਸ਼ਨ ਤੋਂ ਜਾਣੀ ਹੈ ਅਸੀਂ ਜਲਦੀ ਪਹੁੰਚਣਾ ਵੀ ਹੈ ਉੱਥੇ ਸਾਡੇ ਨਾਲ ਬਜ਼ੁਰਗ ਹੈ ਮਾਤਾ ਜੀ ਹੈਗੇ ਸਾਡੇ ਮੇਰੇ ਨਾਲ ਅਤੇ ਉਹਨਾਂ ਕੋਲੋਂ ਤਾਂ ਐਨੀ ਛੇਤੀ ਪੌੜੀਆਂ ਵੀ ਨਹੀਂ ਚੜ੍ਹ ਹੋਣੀਆਂ ਸਟੇਸ਼ਨ ਦੇ ਦੂਜੇ ਪਾਸੇ ਜਾਣ ਲਈ ਤੁਸੀਂ ਜ਼ਰਾ ਟਾਈਮ 'ਤੇ ਆ ਜਾਉ ਤੁਸੀਂ ਸਾਨੂੰ ਟਾਈਮ ਦਿੱਤਾ ਸੀ ਕਿ ਇਸ ਟਾਈਮ ਤੱਕ ਪਹੁੰਚ ਜਾਉਂਗੇ ਹੋਰ ਕਿੰਨੀ ਕੁ ਦੇਰ ਅਸੀਂ ਤੁਹਾਡੀ ਵੇਟ ਕਰੀਏ ਨਹੀਂ ਆਖਰ ਕਾਰਨ ਕੀ ਹੈ ਤੁਸੀਂ ਐਨੀ ਲੇਟ ਕਿਉਂ ਹੋ ਗਏ ਹੋ ਤੁਸੀਂ ਕਿਰਪਾ ਕਰਕੇ ਜ਼ਰਾ ਛੇਤੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਅਸੀਂ ਐਨੀ ਲੇਟ ਔਰ ਐਨੀ ਦੇਰ ਬਾਹਰ ਖੜ੍ਹੇ ਵੀ ਨਹੀਂ ਹੋ ਸਕਦੇ ਮੌਸਮ ਵੀ ਖਰਾਬ ਹੋਣ ਲੱਗਿਆ ਹੈ ਜੇ ਕਿਤੇ ਮੀਂਹ ਆ ਗਿਆ ਤਾਂ ਅਸੀਂ ਤਾਂ ਸਾਰੇ ਇੱਥੇ ਹੀ ਭਿੱਜ ਜਾਣਾ ਜ਼ਰਾ ਛੇਤੀ ਆਉ ਔਰ ਕਿਉਂਕਿ ਅਸੀਂ ਜ਼ਿਆਦਾ ਤੇਜ਼ ਸਪੀਡ ਨਾਲ ਜਾ ਵੀ ਨਹੀਂ ਸਕਦੇ ਕਿਤੇ ਹੁਣ ਤੁਸੀਂ ਸੋਚੋ ਕਿ ਜੇ ਪੰਦਰਾ ਵੀਹ ਮਿੰਟ ਦਾ ਰਸਤਾ ਜੇ ਮੈਂ ਤੁਹਾਨੂੰ ਛੇਤੀ ਪਹੁੰਚਾ ਦਿਆਂਗਾ ਮਾਤਾ ਜੀ ਥੋੜ੍ਹੀ ਤਬੀਅਤ ਠੀਕ ਨਹੀਂ ਹੈ ਉਹਨਾਂ ਦੀ ਤਾਂ ਹੀ ਅਸੀਂ ਟਰੇਨ 'ਤੇ ਜਾ ਰਹੇ ਹਾਂ ਤੁਸੀਂ ਹੁਣ ਪਹੁੰਚ ਜਾਉ ਜਲਦੀ